ਕਿਸੇ ਵੀ ਜਿਹੜੀ ਪ੍ਰਥਾ ਜਾਂ ਰੀਤੀ ਰਿਵਾਜ਼ ਆ ਇਹ ਸਮਾਜਿਕ ਵਰਕਰਾਂ ਵੱਲੋਂ ਖਤਮ ਕਰ ਦਿੱਤੀ ਗਈ ਹੈ ਜਿਵੇਂ ਕਿ ਸਤੀ ਪ੍ਰਥਾ ਸੀ ਉਸ ਵਿੱਚ ਜਦੋਂ ਕਿਸੇ ਇਸਤਰੀ ਦਾ ਪਤੀ ਮਰ ਜਾਂਦਾ ਸੀ ਤਾਂ ਉਸਨੂੰ ਕਹਿੰਦੇ ਸੀ ਕਿ ਜਦੋਂ ਪਤੀ ਦਾ ਸਸਕਾਰ ਹੁੰਦਾ ਅਤੇ ਨਾਲ ਹੀ ਪਤਨੀ ਨੂੰ ਵੀ ਮ ਸਤੀ ਹੋਣਾ ਪੈਂਦਾ ਸੀਗਾ ਇਹ ਸਰਕ ਮ ਸਮਾਜਿਕ ਵਰਕਰਾਂ ਵੱਲੋਂ ਹੌਲੀ ਹੌਲੀ ਇਸ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ ਜੇ ਕੇ ਜੋ ਕਿ ਬਹੁਤ ਵਧੀਆ ਗੱਲ ਆ ਬਾਕੀ ਜਿਹੜੀਆਂ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਰਸਮਾਂ ਨੇ ਜਿਵੇਂ ਆਪਣੇ ਔਰਤਾਂ ਨੂੰ ਸਿੱਖਿਆ ਨਹੀਂ ਦਿੱਤੀ ਜਾਂਦੀ ਸੀ ਬੁਰਕਾ ਪਹਿਨਣਾ ਕੰਨਿਆਂ ਦੀ ਭਰੂਣ ਹੱਤਿਆ ਕਰਨੀ ਇਹ ਵੀ ਬਹੁਤ ਵਧੀਆ ਕੰਮ ਕੀਤਾ ਸਮਾਜਿਕ ਵਰਕਰਾਂ ਨੇ ਉਹਨੂੰ ਖਤਮ ਕਰ ਦਿੱਤਾ ਜਿਵੇਂ ਮੁਸਲਿਮ ਧਰਮ ਦੇ ਵਿੱਚ ਔਰਤ ਨੂੰ ਮੂੰਹ ਢੱਕ ਕੇ ਬੁਰਕਾ ਪਹਿਨ ਕੇ ਹੀ ਜਾਣਾ ਪੈਂਦਾ ਬਾਹਰ ਉਹ ਬਿਲਕੁਲ ਵੀ ਮੂੰਹ ਨੰਗਾ ਕਰਕੇ ਬਾਹਰ ਨਹੀਂ ਸਮਾਜ ਵਿੱਚ ਨਿਕਲ ਸਕਦੀ ਔਰਤਾਂ ਨੂੰ ਸਿੱਖਿਆ ਦੇਣ ਦੇ ਵਿੱਚ ਵੀ ਘਰ ਦੇ ਲੋਕ ਹੀਣ ਭਾਵਨਾ ਮੰਨਦੇ ਸੀ ਵੀ ਸਾਡੀ ਲੜਕੀ ਕਿਸ ਤਰ੍ਹਾਂ ਸਕੂਲਾਂ ਵਿੱਚ ਪੜ੍ਹਨ ਜਾਵੇਗੀ ਇਸ ਚੀਜ਼ ਨੂੰ ਵੀ ਖਤਮ ਕਰਤਾ ਜਿਸ ਤਰ੍ਹਾਂ ਕੰਨਿਆਂ ਨੂੰ ਪੇਟ ਵਿੱਚ ਜਦੋਂ ਪਤਾ ਲੱਗਦਾ ਸੀ ਵੀ ਕੰਨਿਆਂ ਉਹਨੂੰ ਪਹਿਲਾਂ ਹੀ ਉਹਦੀ ਹੱਤਿਆ ਕਰ ਦਿੱਤੀ ਜਾਂਦੀ ਸੀ ਇਹ ਸਾਰੀਆਂ ਪ੍ਰਥਾ ਜੋ ਕਿ ਬਹੁਤ ਹੀ ਗਲਤ ਸੀਗੀਆਂ ਇਹ ਸਮਾਜਿਕ ਵਰਕਰਾਂ ਨੇ ਖਤਮ ਕਰਕੇ ਔਰਤ ਆ ਜਿਹੜੀ ਉਹਨੂੰ ਸਿਰ ਉਠਾਕ ਉ ਉਠਾ ਕੇ ਜਿਊਣ ਦੀ ਮਤਲਬ ਹਿੰਮਤ ਦਿੱਤੀ ਆ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ